ਭੰਗੜੇ ਦੇ ਕੁਝ ਆਮ ਸਟੈਪ ਹਨ ਜਿਵੇਂ ਕਿ ਸਿੰਗਲ ਮਾਹੀਆ ਡਬਲ ਮਾਹੀਆ ਅਤੇ ਫੁੱਲ ਅਤੇ ਇਹਨਾਂ ਵਿੱਚੋਂ ਸਭ ਤੋਂ ਮੁੱਖ ਹੈ ਮੋਰ ਪੰਖੀਆ ਜਿਸ ਨੂੰ ਪੰਜਾਬੀ ਆਮ ਤੌਰ 'ਤੇ ਪਾਉਂਦੇ ਹਨ ਇਹ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਅਤੇ ਇਸ ਦਾ ਪਹਿਰਾਵਾ ਚਾਦਰਾ ਅਤੇ ਕੁੜਤਾ ਅਤੇ ਗਲਾਂ ਦੇ ਵਿੱਚ ਗੱਭਰੂ ਕੈਂਠੇ ਪਾਉਂਦੇ ਹਨ ਜਿਹਨਾਂ ਨਾਲ ਜੁਗਨੀਆਂ ਵੀ ਹੁੰਦੀਆਂ ਹਨ ਅਤੇ ਕੰਨਾਂ ਦੇ ਵਿੱਚ ਨੱਤੀਆਂ ਪਾਈਆਂ ਜਾਂਦੀਆਂ ਹਨ ਅਤੇ ਗੱਭਰੂ ਜੁੱਤੀ ਪਾਉਂਦੇ ਹਨ ਅਤੇ ਇਹ ਟੋਲੀ ਦੇ ਵਿੱਚ ਕੀਤਾ ਜਾਂਦਾ ਹੈ ਜਦ ਗੱਭਰੂ ਭੰਗੜਾ ਪਾਉਂਦੇ ਹਨ ਤਾਂ ਸਾਰੇ ਪੰਜਾਬੀ ਝੂਮਣ ਲੱਗ ਜਾਂਦੇ ਹਨ ਜਿਸ ਨੂੰ ਦੇ ਅਤੇ ਏਜ਼ ਆਮ ਤੌਰ 'ਤੇ ਸਾਰੇ ਹੀ ਪੰਜਾਬੀ ਤਿਉਹਾਰਾਂ 'ਤੇ ਪਾਇਆ ਜਾਂਦਾ ਹੈ ਜਿਵੇਂ ਕਿ ਵਿਸਾਖੀ 'ਤੇ ਵਿਸਾਖੀ ਦਾ ਭੰਗੜਾ ਸਭ ਤੋਂ ਮਸ਼ਹੂਰ ਹੁੰਦਾ ਹੈ ਭੰਗੜਾ ਆਮ ਤੌਰ 'ਤੇ ਲੋਹੜੀ 'ਤੇ ਅਤੇ ਜਦ ਦੋ ਚਾਰ ਪੰਜਾਬੀ ਇਕੱਠੇ ਹੋ ਜਾਂਦੇ ਹਨ ਤਾਂ ਉਹ ਭੰਗੜਾ ਪਾਉਂਦੇ ਹਨ ਇਹ ਇਹ ਬਹੁਤ ਹੀ ਐਨਰਜੀ ਵਾਲਾ ਲੋਕ ਨਾਚ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਚਾਹੀਦੀ ਹੁੰਦੀ ਹੈ